ਪੁੱਛੇ ਗਏ ਸਵਾਲ ਮੁਤਾਬਿਕ ਕੁਝ ਸਭ ਤੋਂ ਆਮ ਗਲਤੀਆਂ ਕੀ ਹਨ ਜੋ ਸ਼ੁਰੂਆਤ ਕਰਨ ਵੇਲੇ ਬੈਕਰ ਕਰਦੇ ਹਨ ਜੋ ਬਾਇਕ ਚਲਾਉਂਦੇ ਹਨ ਸਭ ਤੋਂ ਪਹਿਲਾਂ ਉਹ ਮੇਜਰ ਗਲਤੀਆਂ ਜੋ ਕਰਦੇ ਹਨ ਉਹ ਜਦੋਂ ਵੀ ਸੜਕ ਉੱਤੇ ਆਪਣੇ ਬਾਇਕ ਨੂੰ ਕਿਤੇ ਇੱਕ ਤੋਂ ਦੂਜੇ ਸ਼ਟੇਸ਼ਨ ਤੱਕ ਲੈ ਕੇ ਜਾਂਦੇ ਹਨ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਜੋ ਮੇਜਰ ਗਲਤੀ ਹੁੰਦੀ ਹੈ ਉਹ ਬਾਇਕ ਨੂੰ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਚਲਾਉਂਦੇ ਹਨ ਅਤੇ ਬਹੁਤ ਜ਼ਿਆਦਾ ਭਜਾਉਂਦੇ ਹਨ ਨਾ ਉਹ ਦੇਖਦੇ ਹਨ ਵੀ ਕੋਈ ਕਿੱਧਰਲੀ ਸਾਈਡ ਤੋਂ ਆ ਰਿਹਾ ਹੈ ਜਾਂ ਕੋਈ ਕਿੱਧਰਲੀ ਸਾਈਡ ਨੂੰ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਇਹਨਾਂ ਦੀਆਂ ਮੇਜਰ ਗਲਤੀਆਂ ਇਹ ਹੁੰਦੀਆਂ ਦੂਜੇ ਨੰਬਰ 'ਤੇ ਇਹਨਾਂ ਦੀਆਂ ਗਲਤੀਆਂ ਇਹ ਕਰਦੇ ਹਨ ਕਿ ਜੋ ਬਾਇਕਰ ਹੁੰਦੇ ਹਨ ਜਦੋਂ ਵੀ ਕਿਸੇ ਇਹ ਲੰਬੇ ਰੂਟ 'ਤੇ ਜਾਂਦੇ ਹਨ ਤਾਂ ਇਹ ਬਾਇਕ ਦੀ ਜੋ ਸਪੀਡ ਹੁੰਦੀ ਹੈ ਤਕਰੀਬਨ ਉਹ ਸੱਠ ਸੱਤਰ ਤੋਂ ਵਿਚਕਾਰ ਹੋਣੀ ਚਾਹੀਦੀ ਹੈ ਪਰ ਇਹ ਉਸ ਨੂੰ ਸੌ ਤੋਂ ਉੱਪਰ ਹੀ ਰੱਖਦੇ ਹਨ ਜਿਸ ਨਾਲ ਇਹਨਾਂ ਦੀ ਆਪਣੀ ਜਾਨ ਦਾ ਖਤਰਾ ਤਾਂ ਬਣਿਆ ਰਹਿੰਦਾ ਹੈ ਅਤੇ ਜੋ ਸੜਕ ਦੇ ਉੱਪਰ ਜਾਂ ਰੋਡਾਂ ਦੇ ਉੱਪਰ ਆਮ ਕਿਸਾਨ ਆਮ ਲੋਕ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਜਾਨਵਰ ਚੱਲਦੇ ਹਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਈ ਵਾਰ ਐਕਸੀਡੈਂਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਇਹ ਬਾਇਕਰ ਆਪਣੀਆਂ ਜਾਨਾਂ ਵੀ ਗਵਾਉਂਦੇ ਹਨ ਦੂਜੇ ਤੀਜੇ ਨੰਬਰ 'ਤੇ ਇਹ ਬਾਇਕਰ ਜੋ ਅ ਇਹ ਬਾਇਕਾਂ ਲੈ ਕੇ ਆਉਂਦੇ ਹਨ ਇਹ ਬਹੁਤ ਮਹਿੰਗੇ ਭਾਅ ਦੀਆਂ ਬਾਇਕਾਂ ਹੁੰਦੀਆਂ ਹਨ ਜਿਹਨਾਂ ਦੀਆਂ ਰੇਸਾਂ ਅਤੇ ਸਪੀਡਾਂ ਨੇ ਜੋ ਇਹ ਬਹੁਤ ਜ਼ਿਆਦਾ ਵੱਡੀਆਂ ਸਪੀਡ 'ਤੇ ਭੱਜਣ ਵਾਲੀਆਂ ਹੁੰਦੀਆਂ ਹਨ ਕਿਰਪਾ ਕਰਕੇ ਇਹਨਾਂ ਦੀ ਸਪੀਡ ਵਾਲੀਆਂ ਬਾਇਕਰਾਂ ਦੀਆਂ ਸਪੀਡਾਂ ਵਾਲੀਆਂ ਜ਼ਿਆਦਾ ਸਪੀਡ ਬਾਇਕ ਦੀ ਨਹੀਂ ਹੋਣੀ ਚਾਹੀਦੀ ਇਹ ਸਪੀਡ ਦੇ ਨਾਲ ਨਾਲ ਜਦੋਂ ਸਪੀਡ ਨਾਲ ਬਾਇਕਰਾਂ ਨੂੰ ਬਾਇਕ ਭਜਾਉਂਦੇ ਹਨ ਤਾਂ ਇਹ ਉਸਦੀ ਸੀਟ ਉੱਪਰ ਖੜ੍ਹ ਕੇ ਵੀ ਸਟੰਟ ਕਰਦੇ ਹਨ ਜੋ ਇਹਨਾਂ ਲਈ ਕਾਫੀ ਗਲਤ ਸਾਬਤ ਹੁੰਦੀਆਂ ਹਨ ਜਿਸ ਵਿੱਚ ਕਈ ਬਾਇਕਰ ਆਪਣੀਆਂ ਜਾਨਾਂ ਵੀ ਗਵਾਉਂਦੇ ਹਨ ਇਸ ਇਹਨਾਂ ਨਿਯਮਾਂ ਦੀਆਂ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਜੇਕਰ ਇਹਨਾਂ 'ਤੇ ਕੋਈ ਕਾਨੂੰਨ ਬਣੇ ਤਾਂ ਇਹਨਾਂ ਦਾ ਮੇਨ ਜੋ ਕੋਈ ਗਲਤੀ ਕਰਦਾ ਮੇਜਰ ਫੜਿਆ ਜਾਂਦਾ ਹੈ ਤਾਂ ਉਸ ਦਾ ਲਾਸੰਸ ਹੈ ਜੋ ਉਸ ਨੂੰ ਕੈਂਸਲ ਕੀਤਾ ਜਾਵੇ ਅਤੇ ਉਸਦੀ ਹਾ ਆ ਆਰ ਸੀ ਡੈਮੇਜ ਦੇ ਵਿੱਚ ਪਾਈ ਜਾਵੇ ਤਾਂ ਕਿ ਜੋ ਉਹ ਬਾਈਕਰ ਦੁਆਰਾ ਕਿਸੇ ਵੀ ਰੋਡ 'ਤੇ ਆਪਣੀ ਬਾਈਕ ਨਾ ਚਲਾ ਸਕੇ ਅਤੇ ਨਾ ਹੀ ਕਿਸੇ ਦੀ ਜਾਨ ਨਾਲ ਕੋਈ ਇੱਦਾਂ ਦਾ ਖਿਲਵਾੜ ਕਰ ਸਕੇ ਇਹਨਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਵੱਡੇ ਤੋਂ ਵੱਡੇ ਜੁਰਮਾਨੇ ਲਾਉਣੇ ਚਾਹੀਦੇ ਹਨ ਜਿਸ ਨਾਲ ਇਹ ਆਪਣੇ ਜੁਰਮਾਨੇ ਭਰ ਨਾ ਭਰ ਸਕਣ ਅਤੇ ਇਹ ਆਪਣੀਆਂ ਗਲਤੀਆਂ ਨੂੰ ਸੁਧਾਰਨ ਜੋ ਇਹ ਬਹੁਤ ਜ਼ਿਆਦਾ ਗਲਤੀਆਂ ਕਰਦੇ ਹਨ